ਦੇਸ਼ ਵਿੱਚ ਉਪਲਬਧ ਹਸਪਤਾਲ ਅਤੇ ਡੋਕਟਰੀ ਸੇਵਾਵਾਂ ਖਾਸ ਕਰਕੇ ਸਰਕਾਰੀ ਹਸਪਤਾਲ ਮੇਰੇ ਬਿਲਕੁਲ ਵੀ ਪਸੰਦ ਵਿੱਚ ਨਹੀਂ ਹਨ ਇੱਕ ਵਾਰ ਦੀ ਗੱਲ ਹੈ ਮੇਰੇ ਮਾਤਾ ਜੀ ਨੇ ਪਿੱਤੇ ਦੀ ਪਥਰੀ ਦਾ ਓਪਰੇਸ਼ਨ ਕਰਵਾਉਣਾ ਸੀ ਅਤੇ ਉਹਨਾਂ ਨੇ ਸਰਕਾਰੀ ਹੋਸਪੀਟਲ ਦੇ ਵਿੱਚ ਅਸੀਂ ਗਏ ਅਤੇ ਉਹ ਸਾਨੂੰ ਅੱਗੇ ਅੱਗੇ ਤਰੀਕਾਂ ਦਈ ਗਏ ਪਰ ਉਹਨਾਂ ਨੇ ਆਪਣੇ ਪੇਸ਼ੈਟ ਦੀ ਹਾਲਤ ਨਾ ਦੇਖਦੇ ਹੋਏ ਉਹਨਾਂ ਨੇ ਇਹ ਕੰਮ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਉਹਨਾਂ ਦਾ ਓਪਰੇਸ਼ਨ ਕਰ ਦਈਏ ਇਸ ਕਰਕੇ ਸਰਕਾਰੀ ਹੌਸਪੀਟਲਾਂ ਵਾਲੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹਨ ਅਤੇ ਰਹੀ ਗੱਲ ਕੋਵਿਡ ਮਹਾਂਮਾਰੀ ਦੀ ਤਾਂ ਉਸ ਦੇ ਨਾਲ ਸਾਡਾ ਐਕਸਪੀਰੀਐਂਸ ਸੀਗਾ ਜਿਹੜਾ ਬਹੁਤ ਹੀ ਬੁਰਾ ਰਿਹਾ ਏ ਇਸ ਦੇ ਨਾਲ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਅਤੇ ਇਸ ਲਈ ਮੈਂ ਇਹ ਦੁਆ ਕਰਦੀ ਹਾਂ ਕਿ ਸਰਕਾਰੀ ਹੌਸਪੀਟਲਾਂ ਵਾਲੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਵੱਧ ਤੋਂ ਵੱਧ ਇਹ ਯਤਨ ਕਿ ਅਸੀਂ ਉਹਨਾਂ ਦੀ ਸਿਹਤ ਨੂੰ ਦੇਖੀਏ ਅਤੇ ਛੇਤੀ ਤੋਂ ਛੇਤੀ ਉਹਨਾਂ ਦੇ ਲਈ ਕਦਮ ਚੁੱਕੀਏ ਅਤੇ ਉਹਨਾਂ ਦੀ ਸਿਹਤ ਵੱਲ ਧਿਆਨ ਦਿੰਦੇ ਹੋਏ ਉਹਨਾਂ ਨੂੰ ਜ਼ਰੂਰੀ ਦਵਾਈਆਂ ਅਤੇ ਉਹਨਾਂ ਦੇ ਓਪਰੇਸ਼ਨ ਛੇਤੀ ਤੋਂ ਛੇਤੀ ਕੀਤੇ ਜਾਣ